ਹਾਂ ਮੈਂ ਇੱਕ ਸਮੇਂ ਫੋਟੋਗ੍ਰਾਫੀ ਨੂੰ ਇੱਕ ਪੇਸ਼ੇ ਵਜੋਂ ਲੈਣਾ ਬਾਰੇ ਜਰੂਰ ਸੋਚਿਆ ਸੀ ਮੈਨੂੰ ਹਮੇਸ਼ਾ ਤੋਂ ਹੀ ਤਸਵੀਰਾਂ ਖਿੱਚਣ ਦਾ ਸ਼ੌਂਕ ਰਿਹਾ ਹੈ ਅਤੇ ਮੈਂ ਮੰਨਦਾ ਹਾਂ ਕਿ ਫੋਟੋਗ੍ਰਾਫੀ ਇੱਕ ਬਹੁਤ ਹੀ ਰਚਨਾਤਮਕ ਅਤੇ ਦਿਲਚਸਪ ਕੰਮ ਹੈ ਇਹ ਤੁਹਾਨੂੰ ਦੁਨੀਆਂ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਤੋਂ ਦੇਖਣ ਅਤੇ ਆਪਣੀਆਂ ਭਾਵਨਾਵਾਂ ਨੂੰ ਤਸਵੀਰਾਂ ਰਾਹੀਂ ਜਾਹਰ ਕਰਨ ਦਾ ਮੌਕਾ ਦਿੰਦਾ ਹੈ ਮੈਂ ਖ਼ਾਸ ਤੌਰ 'ਤੇ ਲੋਕਾਂ ਦੀਆਂ ਤਸਵੀਰਾਂ ਖਿੱਚਣ ਦਾ ਆਨੰਦ ਲੈਂਦਾ ਹਾਂ ਅਤੇ ਮੈਂ ਸੋਚਦਾ ਹਾਂ ਕਿ ਫੋਟੋਗ੍ਰਾਫਰ ਹੋਣ ਦੇ ਨਾਤੇ ਮੈਂ ਲੋਕਾਂ ਦੀਆਂ ਜ਼ਿੰਦਗੀ ਵਿੱਚ ਇੱਕ ਸਕਾਰਾਤਮਕ ਫ਼ਰਕ ਲਿਆ ਸਕਦਾ ਹਾਂ ਅੱਜ ਕੱਲ੍ਹ ਵਿਆਹ ਦੀ ਫੋਟੋਗ੍ਰਾਫੀ ਬਹੁਤ ਮਸ਼ਹੂਰ ਹੈ ਅਤੇ ਮੈਂ ਸਮਝਦਾ ਹਾਂ ਕਿ ਕਿਉਂ ਵਿਆਹ ਇੱਕ ਬਹੁਤ ਹੀ ਖ਼ਾਸ ਮੌਕਾ ਹੁੰਦਾ ਹੈ ਅਤੇ ਵਿਆਹ ਦੀਆਂ ਤਸਵੀਰਾਂ ਤੁਹਾਨੂੰ ਉਸ ਦਿਨ ਦੀਆਂ ਯਾਦਾਂ ਨੂੰ ਸਦਾ ਲਈ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੀਆਂ ਹਨ ਹਾਲਾਂਕਿ ਮੈਂ ਇਹ ਵੀ ਸੋਚਦਾ ਹਾਂ ਕਿ ਵਿਆਹ ਦੀ ਫੋਟੋਗ੍ਰਾਫੀ ਨੂੰ ਹੋਰ ਵੀ ਚਰਨਾਤਮਕ ਅਤੇ ਵਿਅਕਤੀਗਤ ਬਣਾਉਣ ਦੀ ਗੁੰਜਾਇਸ਼ ਹੈ ਮੈਂ ਚਾਹੁੰਦਾ ਹਾਂ ਕਿ ਵਿਆਹ ਦੇ ਫੋਟੋਗ੍ਰਾਫਰ ਸਿਰਫ਼ ਰਸਮੀ ਤਸਵੀਰਾਂ ਖਿੱਚਣ ਦੀ ਬਜਾਏ ਜੋੜੇ ਦੀ ਕਹਾਣੀ ਨੂੰ ਦੱਸਣ 'ਤੇ ਵੀ ਧਿਆਨ ਦੇਣ